ਪ੍ਰਸ਼ਾਸਕਾਂ ਵਿਚਕਾਰ ਆਪਸੀ ਤਾਲਮੇਲਾਂ ਦੀਆਂ ਸੰਭਾਵਨਾਵਾਂ ਨੂੰ ਵਧਾ ਕੇ ਜਿਹੜਾ ਆਪਾਂ ਖੇਡਾਂ ਨੂੰ ਪ੍ਰਭਾਵਸ਼ਾਲੀ ਦਿਖਾਉਣ ਲਈ ਟੈਕਨੋਲਜੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ ਕੀ ਹੁੰਦਾ ਹੁਣ ਆਉਣ ਅੱਜ ਕੱਲ੍ਹ ਕੀ ਹੈ ਟੈਕਨੋਲਜੀ ਦੇ ਆਉਣ ਨਾਲ ਜਿਹੜਾ ਆਪਾਂ ਨੂੰ ਪਹਿਲਾਂ ਪ੍ਰੋਗਰਾਮ ਕੋਈ ਵੀ ਮੈਚ ਵਗੈਰਾ ਦੇਖਣ ਲਈ ਆਪਾਂ ਨੂੰ ਪਹਿਲਾਂ ਗਰਾਉਂਡ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਕੀ ਹੈ ਆਪਾਂ ਇਨ੍ਹਾਂ ਨੂੰ ਪ੍ਰੋਗਰਾਮਾਂ ਨੂੰ ਲਾਈਵ ਪ੍ਰਸਾਰਣ ਟੀ ਵੀ ਉੱਤੇ ਦੇਖ ਸਕਦੇ ਹਾਂ ਅੱਜ ਕੱਲ੍ਹ ਜਿਵੇਂ ਜੀਓ ਸਿਨੇਮਾ ਆ ਗਿਆ ਇਨ੍ਹਾਂ ਦੇ ਰਾਹੀਂ ਆਪਾਂ ਘਰ ਬੈਠੇ ਮਬੈਲ ਫੋਨ 'ਤੇ ਵੀ ਆਪਾਂ ਪ੍ਰੋਗਰਾਮ ਕਿਸੇ ਵੀ ਮੈ ਕ੍ਰਿਕਟ ਮੈਚ ਜਾਂ ਉ ਉਹਨੂੰ ਦੇਖ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੇ ਟੈਕਨੋਲਜੀ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਨੇ ਆਪਣੀਆਂ ਫਿੱਟਨੈੱਸ ਟ੍ਰੈਕਰ ਹੈ ਜਿਵੇਂ ਫਿੱਟਨੈੱਸ ਟ੍ਰੈਕਰ ਵਿੱਚ ਕੀ ਹੈਗਾ ਆਪਾਂ ਖਿਡਾਰੀ ਦੀ ਨਿਪੁੰਨਤਾ ਨੂੰ ਦੇਖ ਸਕਦੇ ਵੀ ਖਿਡਾਰੀ ਕਿੰਨਾ ਕੁ ਨਿਪੁੰਨ ਹੈ ਉਹ ਕਿਹੜੀ ਗੇਮ ਖੇ ਕ ਕੀ ਗੇਮ ਖੇਡਣ ਲਈ ਇਹ ਸਹੀ ਹੈ ਜਾਂ ਗਲਤ ਹੈ ਉਸ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ ਸਮਾਟ ਹੈਲਮਟਸ ਆ ਗਏ ਸਮਾਟ ਹੈਲਮਟ ਵਿੱਚ ਆ ਗਏ ਪਹਿਲਾਂ ਖਿਡਾਰੀਆਂ ਨੂੰ ਜਿਹੜੇ ਹੈਲਮਟ ਹੁੰਦੇ ਸੀ ਉਹ ਵਧੀਆ ਕੁਆਲਟੀ ਦੇ ਨਹੀਂ ਹੁਣ ਜਿਹੜੇ ਹੈਲਮਟ ਹੈ ਉਨ੍ਹਾਂ ਵਿੱਚ ਏਦਾਂ ਦੀਆਂ ਚੀਜ਼ਾਂ ਲਗਾਈਆਂ ਜਿਹਦੇ ਵਿੱਚ ਖਿਡਾਰੀਆਂ ਨੂੰ ਨੁਕਸਾਨ ਘੱਟ ਪਹੁੰਚੇ ਕੋਈ ਵੀ ਅਗਰ ਕੋਈ ਚੀਜ਼ ਵੱਜਦੀ ਹੈ ਖਿਡਾਰੀ ਦੇ ਉਸਨੂੰ ਨੁਕਸਾਨ ਘੱਟ ਪਹੁੰਚੇ ਇਸਦੇ ਜਿਵੇਂ ਸਾਰੀਆਂ ਖੇਡਾਂ ਦਾ ਵਿਛ ਆਪਾਂ ਜਿਵੇਂ ਖੇਡਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਕੁਛ ਟੀਮਾਂ ਦੀ ਜਾਣਕਾਰੀ ਇਕੱਠੀ ਕਰਦੇ ਹਾਂ ਉਨ੍ਹਾਂ ਦੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਬਾਅਦ ਉਹਨਾਂ ਦਾ ਵ ਉਹਨਾਂ ਦੇ ਜਿਹੜੇ ਉਨ੍ਹਾਂ ਦੇ ਵੀਕ ਵੀਕ ਉਹ ਵੀਕ ਪੁਆਇੰਟ ਨੇ ਉਨ੍ਹਾਂ ਉੱਤੇ ਅਭਿਆਸ ਕਰਦੇ ਹਾਂ ਅਭਿਆਸ ਕਰਨ ਦੇ ਨਾਲ ਉਨ੍ਹਾਂ ਖਿਡਾਰੀਆਂ ਦੇ ਸਾਰਿਆਂ ਖਿਡਾਰੀਆਂ ਦੇ ਅੰਕੜੇ ਇਕੱਠੇ ਕਰਦੇ ਹਾਂ ਅੰਕੜੇ ਇਕੱਠੇ ਕਰਕੇ ਉਨ੍ਹਾਂ ਨੂੰ ਟੀਮ ਦੇ ਵਿੱਚ ਵੀ ਕਿੱਥੇ ਕੀ ਕਮੀ ਹੈ ਉਸਦਾ ਆਪਾਂ ਫੈਸਲਾ ਕਰਦੇ ਹਾਂ ਵੀ ਕਿ ਇਨ੍ਹਾਂ ਕਮੀਆਂ ਨੂੰ ਕਿਵੇਂ ਦੂਰ ਕੀਤਾ ਜਾਂਦਾ ਇਹ ਸਾਰਾ ਕੁਛ ਆਪਾਂ ਟੈਕਨੋਲਜੀ ਦੀ ਮਦਦ ਨਾਲ ਹੀ ਕਰਦੇ ਜਿਵੇਂ ਟੈਕਨੋਲਜੀ ਦੇ ਨਾਲ ਇੱਕ ਆਪਾਂ ਜਿਵੇਂ ਖੇਡ ਖੇਡਦੇ ਖੇਡ ਦੇ ਦੌਰਾਨ ਵੀ ਟੈਕਨੋਲਜੀ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਕੋਈ ਵੀ ਹੁਣ ਕ੍ਰਿਕਟ ਵਿੱਚ ਹੀ ਲਾ ਲਉ ਆਪਾਂ ਜਦੋਂ ਆਊਟ ਹੁੰਦਾ ਹੈ ਕਈ ਵਾਰੀ ਆਊਟ ਦਾ ਨਹੀਂ ਪਤਾ ਲੱਗਦਾ ਤਾਂ ਉਸ ਨੂੰ ਪਤਾ ਕਰਨ ਲਈ ਥਰਡ ਅੰਪਾਇਰ ਤੋਂ ਪਤਾ ਕੀਤਾ ਜਾਂਦਾ ਥਰਡ ਅੰਪਾਇਰ ਕੈਮਰੇ ਵਿੱਚ ਕੈਮਰੇ ਵਿੱਚ ਜੋ ਰਿਕੋਡਿੰਗ ਹੁੰਦੀ ਉਸ ਵਿੱਚ ਦੇਖ ਕੇ ਦੱਸਦਾ ਵੀ ਆਊਟ ਹੈਗਾ ਜਾਂ ਨਹੀਂ ਹੈਗਾ ਇਸ ਤਰ੍ਹਾਂ ਖੇਡਾਂ ਵਿੱਚ ਤਾਂ ਟੈਕਨੋਲਜੀ ਦੀ ਬਹੁਤ ਜ਼ਿਆਦਾ ਹੀ ਵਰਤੋਂ ਕੀਤੀ ਕੀਤੀ ਗਈ ਹੈ ਇਸ ਕਰਕੇ ਟੈਕਨੋਲਜੀ ਦੀ ਵਰਤੋਂ ਬਹੁਤ ਵਧੀਆ ਹੈ ਧੰਨਵਾਦ